ਮੈਨੂੰ ਸਕੂਲ ਟਾਈਮ ਵਿੱਚ ਇੱਕ ਪ੍ਰੋਜੈਕਟ ਮਿਲਿਆ ਸੀ ਜੋ ਥੋੜ੍ਹਾ ਮੁਸ਼ਕਲ ਸੀ ਇਹ ਪ੍ਰੋਜੈਕਟ ਸਾਇੰਸ ਦੀ ਇੱਕ ਐਕਟੀਵਿਟੀ ਨਾਲ ਸੰਬੰਧਿਤ ਸੀ ਸਾਡੇ ਅਧਿਆਪਕ ਨੇ ਇੱਕ ਪ੍ਰੋਜੈਕਟ ਦੋ ਵਿਦਿਆਰਥੀਆਂ ਨੂੰ ਦਿੱਤਾ ਸੀ ਤਾਂ ਜੋ ਦੋ ਵਿਦਿਆਰਥੀ ਇਕੱਠੇ ਮਿਲ ਕੇ ਇੱਕ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰ ਸਕਣ ਮੇਰੇ ਨਾਲ ਮੇਰੀ ਇੱਕ ਕਲਾਸਮੇਟ ਸੀ ਪਰੰਤੂ ਮੈਨੂੰ ਉਸ ਨਾਲ ਪ੍ਰੋਜੈਕਟ ਤਿਆਰ ਕਰਨ ਵਿੱਚ ਦਿਲਚਸਪੀ ਨਹੀਂ ਸੀ ਕਿਉਂਕਿ ਉਹ ਆਪਣੇ ਵਿਚਾਰ ਬਹੁਤ ਘੱਟ ਸਾਂਝੇ ਕਰਦੀ ਸੀ ਉਹ ਸਮੇਂ ਸਿਰ ਸਕੂਲ ਵੀ ਨਹੀਂ ਸੀ ਆਉਂਦੀ ਅਤੇ ਜ਼ਿਆਦਾ ਸਮਾਂ ਪ੍ਰੋਜੈਕਟ 'ਤੇ ਨਹੀਂ ਲਗਾਉਂਦੀ ਸੀ ਜਿਸ ਨਾਲ ਮੈਨੂੰ ਉਸਨੂੰ ਮਿਲਣ ਵਿੱਚ ਮੁਸ਼ਕਲ ਆਉਂਦੀ ਸੀ ਉਸਦਾ ਘਰ ਵੀ ਮੇਰੇ ਘਰ ਵੀ ਤੋਂ ਦੂਰ ਸੀ ਜਿਸ ਨਾਲ ਮੈਂ ਉਸ ਨਾਲ ਗੱਲਬਾਤ ਨਹੀਂ ਕਰ ਪਾਉਂਦੀ ਸਾਂ ਇਸ ਉਸਨੂੰ ਇਸ ਪ੍ਰੋਜੈਕਟ ਵਿੱਚ ਕੋਈ ਦਿਲਚਸਪੀ ਵੀ ਨਹੀਂ ਸੀ ਜਿਸ ਕਾਰਨ ਇਹ ਪ੍ਰੋਜੈਕਟ ਮੈਨੂੰ ਇਕੱਲੇ ਹੀ ਤਿਆਰ ਕਰਨਾ ਪੈਣਾ ਸੀ ਇਸ ਮੁਸ਼ਕਲ ਵਿੱਚ ਮੈਂ ਆਪਣੇ ਕੁਝ ਫਰੈਂਡਸ ਦੀ ਮਦਦ ਲਈ ਮੈਂ ਉਹਨਾਂ ਨੂੰ ਆਪਣੀ ਮੁਸ਼ਕਲ ਦੱਸੀ ਅਤੇ ਮੇਰੇ ਫਰੈਂਡਸ ਨੇ ਮੇਰੇ ਨਾਲ ਮਿਲ ਕੇ ਮੇਰਾ ਪ੍ਰੋਜੈਕਟ ਤਿਆਰ ਕਰਨ ਦਾ ਫੈਸਲਾ ਲਿਆ ਉਹਨਾਂ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਮੇਰਾ ਪ੍ਰੋਜੈਕਟ ਕੰਪਲੀਟ ਕਰਨ ਵਿੱਚ ਸਹਾਇਤਾ ਕੀਤੀ ਇਸ ਤਰ੍ਹਾਂ ਇਹ ਪ੍ਰੋਜੈਕਟ ਮੈਂ ਤਿਆਰ ਕੀਤਾ ਅਤੇ ਇਸ ਸਥਿਤੀ ਨੂੰ ਸੁਲਝਾਇਆ ਅਤੇ ਫਿਰ ਮੈਂ ਆਪਣੇ ਫਰੈਂਡਸ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਮੇਰੀ ਲੋੜ ਸਮੇਂ ਸਹਾਇਤਾ ਕਰਕੇ ਮੈਨੂੰ ਮੇਰੇ ਪ੍ਰੋਜੈਕਟ ਨੂੰ ਟਾਈਮ ਸਿਰ ਬਣਾਉਣ ਵਿੱਚ ਸਹਾਇਤਾ ਕੀਤੀ ਧੰਨਵਾਦ